ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਮ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਸੀ ਆਪਣੇ ਸਕੂਲ ਵਿੱਚ ਨਾ ਬੱਚੇ ਅਸੈਂਬਲੀ 'ਚ ਨਹੀਂ ਆਉਂਦੇ ਨਾ ਹੀ ਉਹਨਾਂ ਦਾ ਕੋਈ ਡਿਸਪਲਨ ਆ ਅਤੇ ਛੁੱਟੀ ਵੇਲੇ ਵੀ ਕਈ ਵਰੀ ਉਹ ਕੰਧਾਂ ਟੱਪ ਕੇ ਭੱਜ ਜਾਂਦੇ ਆ ਬਾਹਰ ਮੈਂ ਤੁਹਾਡੇ ਨਾਲ ਇਹੀ ਚਰਚਾ ਕਰਨੀ ਸੀ ਵੀ ਤੁਸੀਂ ਪ੍ਰਿੰਸੀਪਲ ਨਾਲ ਗੱਲ ਕਰੋ ਅਤੇ ਉਹਨਾਂ ਨੂੰ ਦੱਸੋ ਵੀ ਐਵੇਂ ਵੀ ਡਿਸਿਪਲਨ ਬਣਾ ਕੇ ਰੱਖਣ ਬੱਚੇ ਹਾਂਜੀ ਮੈਮ ਅਤੇ ਹੋਰ ਵੀ ਕਈ ਸਮੱਸਿਆਵਾਂ ਨੇ ਕਲਾਸਾਂ ਵਿੱਚ ਬੱਚਿਆਂ ਦੇ ਡੈਕਸ ਟੁੱਟੇ ਹੋਏ ਨੇ ਅਤੇ ਉਹ ਕਈ ਵਾਰੀ ਖੇਡਦੇ ਤੋੜ ਦਿੰਦੇ ਆ ਤੁਸੀਂ ਗੱਲ ਕਰਿਓ ਹਾਂਜੀ ਅਤੇ ਹੋਰ ਵੀ ਕਈ ਸਮੱਸਿਆਵਾਂ ਨੇ ਮੈਮ ਜਿਨ੍ਹਾਂ ਬਾਰੇ ਤੁਸੀਂ ਪ੍ਰਿੰਸੀਪਲ ਨਾਲ ਚਰਚਾ ਕਰਿਓ ਜ਼ਰੂਰ ਹਾਂਜੀ ਹਾਂਜੀ ਹਾਂਜੀ ਬੱਚੇ ਅਸੈਂਬਲੀ 'ਚ ਵੀ ਨਹੀਂ ਆਉਂਦੇ ਸੁਬਹਾ ਹਾਂਜੀ ਹਾਂਜੀ ਹਾਂਜੀ ਬਸ ਇਹੀ ਵੀ ਆ ਬੱਚੇ ਕੰਧਾਂ ਟੱਪ ਜਾਂਦੇ ਨੇ ਹਾਂਜੀ ਅਤੇ ਹੋਰ ਵੀ ਕਈ ਸਮੱਸਿਆਵਾਂ ਨੇ ਬਸ ਤੁਸੀਂ ਪ੍ਰਿੰਸੀਪਲ ਨਾਲ ਗੱਲ ਕਰ ਲਿਓ ਹਾਂਜੀ ਹਾਂਜੀ ਅਤੇ ਹੁਣ ਓਕੇ ਮੈਮ